ਮੈਨੂੰ ਬਚਪਨ ਵਿੱਚ ਡਾਕ ਟਿਕਟਾਂ ਪਹਾੜਾਂ ਦੀਆਂ ਸਿਨਰੀਆਂ ਸਿੱਕੇ ਅਤੇ ਹੋਰ ਐਂਟੀਕ ਚੀਜ਼ਾਂ ਜੋ ਪੁਰਾਣੀਆਂ ਹੁੰਦੀਆਂ ਸਨ ਇਕੱਠੀਆਂ ਕਰਨ ਦਾ ਕਾਫੀ ਸ਼ੌਕ ਸੀ ਅਤੇ ਮੈਂ ਆਪਣੇ ਦੋਸਤਾਂ ਮਿੱਤਰਾਂ ਨੂੰ ਆਪਣੀਆਂ ਇਹਨਾਂ ਸਭ ਇਕੱਠੀਆਂ ਕੀਤੀਆਂ ਕਲੈਕਸ਼ਨਾਂ ਵਿਖਾਉਂਦਾ ਜੋ ਕਿ ਮੈਨੂੰ ਬਹੁਤ ਹੀ ਵਧੀਆ ਲੱਗਦਾ ਸੀ ਅਤੇ ਮੇਰੇ ਦੋਸਤ ਮਿੱਤਰ ਵੀ ਮੇਰੀ ਤਰ੍ਹਾਂ ਸਿੱਕਿਆਂ ਚਟਾਨਾਂ ਦੀਆਂ ਸੀਨਰੀਆਂ ਅਤੇ ਡਾਕ ਟਿਕਟਾਂ ਆਦਿ ਦੀ ਕਲੈਕਸ਼ਨ ਕਰਨ ਲੱਗ ਜਾਂਦੇ ਸਨ ਫਿਰ ਅਸੀਂ ਇੱਕ ਦੂਜੇ ਨੂੰ ਆਪਣੀਆਂ ਇਹ ਇਕੱਠੀਆਂ ਕੀਤੀਆਂ ਹੋਈਆਂ ਕਲੈਕਸ਼ਨਾਂ ਜਿਵੇਂ ਕਿ ਡਾਕ ਟਿਕਟਾਂ ਸੀਨਰੀਆਂ ਸਿੱਕੇ ਅਤੇ ਹੋਰ ਪੁਰਾਣੀ ਸਮੱਗਰੀ ਬਾਰੇ ਚਰਚਾ ਵੀ ਕਰਿਆ ਕਰਦੇ ਸਨ ਪੁਰਾਣੇ ਸਮਿਆਂ ਦੇ ਸਿੱਕੇ ਵੀ ਕਾਫੀ ਵਧੀਆ ਹੁੰਦੇ ਸਨ ਜਿਹਨਾਂ ਨੂੰ ਇਕੱਠਾ ਕਰਨਾ ਸਾਨੂੰ ਵਧੀਆ ਲੱਗਦਾ ਸੀ ਮੈਨੂੰ ਇਸ ਦਾ ਸ਼ੌਕ ਬਚਪਨ ਤੋਂ ਹੀ ਰਿਹਾ ਹੈ ਜਿਵੇਂ ਜਿਵੇਂ ਸਮਾਂ ਲੰਘਦਾ ਗਿਆ ਮੇਰਾ ਇਹ ਸ਼ੌਕ ਵੀ ਅੱਗੇ ਹੀ ਵੱਧਦਾ ਗਿਆ ਅਤੇ ਹੁਣ ਮੇਰੇ ਕੋਲ ਪੁਰਾਣੇ ਸਮੇਂ ਦੇ ਸਿੱਕਿਆਂ ਦੀ ਕਾਫੀ ਜ਼ਿਆਦਾ ਕਲੈਕਸ਼ਨ ਹੈ ਜੋ ਕਿ ਮੈਂ ਸਾਂਭ ਕੇ ਰੱਖੀ ਹੋਈ ਹੈ ਮੇਰੀ ਤਰ੍ਹਾਂ ਮੇਰੇ ਦੋਸਤ ਮਿੱਤਰ ਜੋ ਕਿ ਬਚਪਨ 'ਚ ਮੇਰੇ ਨਾਲ ਹੀ ਪੜ੍ਹਦੇ ਸਨ ਉਹ ਵੀ ਇਹਨਾਂ ਚੀਜ਼ਾਂ ਨੂੰ ਹੁਣ ਤੱਕ ਸੰਭਾਲੀ ਬੈਠੇ ਹਨ ਪੁਰਾਣੀਆਂ ਚੀਜ਼ਾਂ ਦੀ ਇਹ ਕਲੈਕਸ਼ਨ ਸਾਨੂੰ ਪੁਰਾਣੇ ਸਮੇਂ ਦੀਆਂ ਯਾਦਾਂ ਨਾਲ ਜੋੜ ਕੇ ਰੱਖਦੀ ਹੈ ਧੰਨਵਾਦ